ਪੰਜਾਬ ਸਰਕਾਰ ਨੇ ਆਪਣਾ ਇੱਕ ਵੈੱਬਸਾਈਟ ਇੱਕ ਪੋਰਟਲ ਤਿਆਰ ਕੀਤਾ ਹੈ ਪੀ ਐਲ ਆਰ ਐਸ ਡੋਟ ਓ ਆਰ ਜੀ ਪੰਜਾਬ ਲੈਂਡ ਰਿਕਾਰਡ ਸੋਸਾਇਟੀ ਡੋਟ ਓ ਆਰ ਜੀ ਜਿਸ ਉੱਪਰ ਜਾ ਕੇ ਲੋਕ ਆਪਣੀ ਮਲਕੀਅਤ ਦਾ ਵੇਰਵਾ ਜਾਣ ਸਕਦੇ ਹਨ ਅਰੇ ਅਤ ਅਤੇ ਕੀ ਉਹ ਦਰੁਸਤ ਹੈ ਜਾਂ ਨਹੀਂ ਦਰੁਸਤ ਹੈ ਅਤੇ ਅਗਰ ਉਹਦੇ ਵਿੱਚ ਕੋਈ ਤਰੁਟੀ ਹੈ ਤਾਂ ਕਿੱਦਾਂ ਉਹਨੂੰ ਠੀਕ ਕੀਤਾ ਜਾ ਸਕਦਾ ਹੈ ਇਹ ਵੀ ਉਸ ਵੈਬਸਾਈਟ ਦੇ ਥਰੂ ਹੀ ਪਤਾ ਲੱਗ ਜਾਂਦਾ ਹੈ ਹੁਣ ਅਗਰ ਤੁਹਾਨੂੰ ਲੱਗੇ ਕਿ ਤੁਹਾਡਾ ਜਿਹੜਾ ਡਾਟਾ ਵੈ ਕਿਸੇ ਵੀ ਜ਼ਮੀਨ ਦੀ ਮਲਕੀਅਤ ਜਿਹੜੀ ਹੈ ਉਹਦਾ ਜਿਹੜਾ ਡਾਟਾ ਪਿਆ ਹੈ ਉਹ ਦਰੁਸਤ ਨਹੀਂ ਹੈ ਤਾਂ ਜਿਹੜਾ ਸਭ ਤੋਂ ਪਹਿਲਾ ਕਦਮ ਹੈ ਉਹ ਕਿਸੇ ਵੀ ਵਾਸਤੇ ਇਹ ਹੈ ਕਿ ਉਹ ਸੰਬੰਧਿਤ ਪਟਵਾਰੀ ਦੇ ਨਾਲ ਜਿਹੜਾ ਆ ਉਹ ਰਾਬਤਾ ਕਾਇਮ ਕਰੇ ਪਟਵਾਰੀ ਹੀ ਇੱਕ ਐਸਾ ਨੁਮਾਇੰਦਾ ਹੈ ਜਿਹਦੀ ਰਿਪੋਰਟ ਦੇ ਉੱਪਰ ਚਾਹੇ ਉਹ ਕਾਨੂੰਨੀ ਵਿਵਸਥਾ ਹੈ ਚਾਹੇ ਸਰਕਾਰ ਹੈ ਚਾਹੇ ਜ਼ਿਲ੍ਹਾ ਪਰਭਾਸਨ ਪ੍ਰਸ਼ਾਸਨ ਹੈ ਉਹ ਪਟਵਾਰੀ ਦੀ ਰਿਪੋਰਟ 'ਤੇ ਹੀ ਕਾਰਵਾਈ ਹੋਏਗੀ ਅਤੇ ਨੱਬੇ ਪ੍ਰਤੀਸ਼ਤ ਕੇਸਾਂ ਦੇ ਵਿੱਚ ਆਪਾਂ ਇਹ ਦੇਖਿਆ ਹੈ ਕਿ ਜੇ ਪਟਵਾਰੀ ਦੀ ਰਿਪੋਰਟ ਜਿਹੜੀ ਹੈ ਅਗਰ ਉਹਦੇ ਵਿੱਚ ਹੀ ਦਰੁਸਤ ਕਰ ਲਿਆ ਜਾਵੇ ਰਿਕਾਰਡ ਤਾਂ ਬਾਕੀ ਪੋਰਟਲਾਂ ਦੇ ਉੱਪਰ ਆਪਣੇ ਆਪ ਹੀ ਦਰੁਸਤ ਹੋ ਜਾਂਦਾ ਹੈ ਸੋ ਪਹਿਲਾ ਜਿਹੜਾ ਕੰਮ ਹੈ ਉਹ ਪਟਵਾਰੀ ਦਾ ਰਿਪੋਰਟ ਠੀਕ ਕਰਨਾ ਹੈ ਉਸ ਤੋਂ ਇਲਾਵਾ ਅਗਰ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਇਹ ਇਦਾਂ ਲੱਗਦਾ ਹੈ ਆਪਾਂ ਨੂੰ ਕਿ ਇਹਦੇ ਨਾਲ ਠੀਕ ਨਹੀਂ ਹੋ ਰਿਹਾ ਤਾਂ ਫਿਰ ਸੰਬੰਧਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਆਪਾਂ ਲਾਬਤਾ ਰਾਬਤਾ ਕਾਇਮ ਕਰ ਸਕਦੇ ਹਾਂ ਜਿਹਦੇ ਕਰਕੇ ਜਿਸ ਜਿਸ ਤੋਂ ਬਾਅਦ ਇੱਕ ਕੁਕ ਕਮੇਟੀ ਬਣਾ ਦਿੱਤੀ ਜਾਂਦੀ ਹੈ ਜਿਹੜੀ ਲੋਕ ਅਦਾਲਤ ਦੀ ਤਰ੍ਹਾਂ ਕੰਮ ਕਰਕੇ ਮੁੱਦੇ ਦਾ ਜਿਹੜਾ ਸਲਊਸ਼ਨ ਹੈ ਉਹ ਪ੍ਰੋਵਾਈਡ ਕਰਦੀ